ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਵੱਖ ਵੱਖ ਖੇਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਪੰਜਾਬੀ ਭਾਸ਼ਾ ਨੁੂੰ ਬਹੁਤ ਹੀ ਪੰਜਾਬੀ ਭਾਸ਼ਾ ਨੂੰ ਹਰ ਖੇਤਰ ਵਿੱਚ ਬਹੁਤ ਹੀ ਮਾਨਤਾ ਦਿੱਤੀ ਜਾ ਰਹੀ ਹੈ ਜਿਵੇਂ ਕਿ ਸਾਡੀ ਪੰਜਾਬੀ ਭਾਸ਼ਾ ਪੰਜਾਬ ਵਿੱਚ ਤਾਂ ਪਹਿਲੇ ਪੱਧਰ 'ਤੇ ਹੈ ਪਰ ਇਹ ਹੁਣ ਹਿੰਦੋਸਤਾਨ ਅਤੇ ਬਾਹਰਲੇ ਮੁਲਕਾਂ ਵਿੱਚ ਵੀ ਬਹੁਤ ਹੀ ਮਸ਼ਹੂਰ ਹੋ ਰਹੀ ਹੈ ਜਿਵੇਂ ਕਿ ਅੱਜ ਕੱਲ੍ਹ ਸ਼ੋਸ਼ਲ ਮੀਡੀਆ 'ਤੇ ਵੀ ਪੰਜਾਬੀ ਪਹਿਲੇ ਪੱਧਰ 'ਤੇ ਹੈ ਅੱਜ ਕੱਲ੍ਹ ਰੇਡੀਓ ਟੈਲੀਵਿਜ਼ਨ ਅਤੇ ਫੋਨ ਵਿੱਚ ਪੰਜਾਬੀ ਭਾਸ਼ਾ ਵ ਵਿੱਚ ਸਮਾਚਾਰ ਨਾਟਕ ਫਿਲਮਾਂ ਆਦਿ ਸਭ ਦਾ ਪ੍ਰਦਰਸ਼ਨ ਕਰਕੇ ਪੰਜਾਬੀ ਨੂੰ ਹੋਰ ਵੀ ਅੱਗੇ ਵਧਾਇਆ ਜਾ ਰਿਹਾ ਹੈ ਧੰਨਵਾਦ